ਤਰਨਤਾਰਨ ਇਲਾਕੇ ਵਿੱਚ ਵੱਖ ਵੱਖ ਧਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਇਸ ਵਿੱਚ ਸਿੱਖ ਹਿੰਦੂ ਮੁਸਲਮਾਨ ਕ੍ਰਿਸ਼ਨ ਬੁੱਧ ਜੈਨ ਅਤੇ ਇਸਾਈ ਧਰਮਾਂ ਦੀ ਪਾਲਣਾ ਕੀਤੀ ਜਾਂਦੀ ਹੈ ਭਾਈਚਾਰੇ ਇਹ ਭਾਈਚਾਰਾ ਬਹੁਤ ਪ੍ਰਭਾਵਸ਼ਾਲੀ ਹੁੰਦਾ ਹੈ ਜਿੱਥੇ ਲੋਕ ਇੱਕ ਦੂਜੇ ਦੀ ਮਦਦ ਕਰਦੇ ਹਨ ਅਤੇ ਸਾਂਝੀ ਸਮੱਸਿਆਵਾਂ ਦਾ ਹੱਲ ਢੰਗ ਨਾਲ ਕੱਢ ਲੈਂਦੇ ਹਨ ਇਸ ਇਲਾਕੇ ਵਿੱਚ ਲੋਕ ਵਿਭਿੰਨਤਾ ਨੂੰ ਸਵੀਕਾਰ ਕਰਦੇ ਹਨ ਅਤੇ ਇੱਕ ਦੂਸਰੇ ਨੂੰ ਸਨਮਾਨਿਤ ਕਰਦੇ ਹਨ ਇਸ ਤਰ੍ਹਾਂ ਸੰਘਰਸ਼ ਸਹਾਇਤਾ ਅਤੇ ਆਪਸੀ ਸਹਿਯੋਗ ਦੇ ਮਹੌਲ ਵਿੱਚ ਭਾਈਚਾਰੇ ਨੂੰ ਵਧਾਇਆ ਜਾ ਸਕਦਾ ਹੈ ਇਲਾਕੇ ਵਿੱਚ ਸਾਂਝੇ ਉਤਸ਼ਾਹ ਪ੍ਰਗਟਾਵਾ ਅਤੇ ਸਾਂਝੀ ਸਮੱਸਿਆਵਾਂ ਦਾ ਸੰਚਾਰ ਹੁੰਦਾ ਹੈ ਜੋ ਭਾਈਚਾਰੇ ਨੂੰ ਵਧਾਉਂਦਾ ਹੈ ਅਤੇ ਲੋਕਾਂ ਨੂੰ ਬਿਹਤਰ ਅਨੁਭਵ ਕਰਾਉਂਦਾ ਹੈ ਭਾਈਚਾਰਾ ਇਲਾਕੇ ਵਿੱਚ ਲੋਕਾਂ ਦੇ ਵਿਕਾਸ ਲਈ ਮੁੱਖ ਭੂਮਿਕਾ ਅਦਾ ਕਰਦਾ ਹੈ